ਪੰਜਾਬ ਦੇ ਕਾਫੀ ਬੜੇ ਸ਼ਹਿਰਾਂ ਦੇ ਅੰਦਰ ਮਸ਼ੀਨ ਲਰਨਿੰਗ ਅਤੇ ਡੇਟਾ ਸਾਇੰਸ ਸੀ ਵਰਤੋਂ ਕੀਤੀ ਜਾ ਰਹੀ ਹੈ ਜਿਵੇਂ ਕਿ ਬਠਿੰਡਾ ਅੰਮ੍ਰਿਤਸਰ ਮੋਹਾਲੀ ਇਹ ਸਾਰੇ ਸ਼ਹਿਰਾਂ ਦੇ ਅੰਦਰ ਟਰੈਫਿਕ ਦਾ ਅੰਦਾਜ਼ਾ ਲਗਾਉਣ ਵਾਸਤੇ ਡੇਟਾ ਸਾਇੰਸ ਦੀ ਵਰਤੋਂ ਹੁੰਦੀ ਹੈ ਜਿਵੇਂ ਕਿ ਡੇਟਾ ਕਲੈਕਸ਼ਨ ਦੇ ਨਾਲ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਵੀ ਕਿੱਥੇ ਕਿੱਥੇ ਟ੍ਰੈਫਿਕ ਵੱਧ ਰਿਹਾ ਹੈ ਅਤੇ ਉਹਨਾਂ ਨੂੰ ਉੱਥੇ ਜਾਣ ਦੀ ਲੋੜ ਹੈ ਇਸਦੇ ਬਾਵਜੂਦ ਡੇਟਾ ਕਲੈਕਸ਼ਨ ਦੇ ਨਾਲ ਇਹ ਵੀ ਪਤਾ ਕੀਤਾ ਜਾ ਸਕਦਾ ਹੈ ਵੀ ਕਿੱਥੇ ਨਵੀਂ ਸੜਕਾਂ ਬਣਾਉਣ ਦੀ ਲੋੜ ਹੈ ਜਾਂ ਸੜਕਾਂ ਨੂੰ ਬੜੀ ਕਰਨ ਦੀ ਲੋੜ ਹੈ ਜਿਹਦੇ ਨਾਲ ਲੋਕਾਂ ਨੂੰ ਆਪਣੀ ਜਗ੍ਹਾ 'ਤੇ ਪਹੁੰਚਣ ਵਾਸਤੇ ਆਸਾਨੀ ਹੋਵੇ ਉਸਦੇ ਨਾਲ ਡੇਟਾ ਕਲੈਕਸ਼ਨ ਦੇ ਨਾਲ ਬਿਲਡਰਸ ਨੂੰ ਇਹ ਵੀ ਪਤਾ ਲੱਗਦਾ ਹੈ ਵੀ ਕਿੱਥੇ ਨਵੀਂ ਇਮਾਰਤ ਬਣਾਈ ਜਾ ਸਕੇ ਜਿਹਦੇ ਨਾਲ ਆਫਿਸ ਪਾਰਕਸ ਬਣਾਏ ਜਾ ਸਕਣ ਜਿਵੇਂ ਕਿ ਕਿਹੜਾ ਏਰੀਆ ਮਾਰਕੀਟ ਦੇ ਕੋਲ ਹੋਏਗਾ ਜਿਹਦੇ ਨਾਲ ਲੋਕ ਉੱਥੇ ਜ਼ਿਆਦਾ ਆਉਣਗੇ ਅਤੇ ਉਹਨਾਂ ਨੂੰ ਫਾਇਦਾ ਹੋਏਗਾ ਜੇ ਆਪਾਂ ਇਸ ਚੀਜ਼ ਬਾਰੇ ਦੇਖੀਏ ਤਾਂ ਡੇਟਾ ਸਾਇੰਸ ਅਤੇ ਮਸ਼ੀਨ ਲਰਨਿੰਗ ਪੰਜਾਬ ਨੂੰ ਅੱਗੇ ਵਧਣ ਦੇ ਵਿੱਚ ਕਾਫੀ ਮਦਦ ਕਰ ਰਿਹਾ ਹੈ ਅਤੇ ਜੇ ਇਹ ਚੀਜ਼ ਛੋਟੇ ਸ਼ਹਿਰਾਂ ਦੇ ਅੰਦਰ ਵੀ ਆ ਜਾਵੇ ਤਾਂ ਫਿਰ ਜਿਹੜੇ ਲੋਕ ਛੋਟੇ ਸ਼ਹਿਰਾਂ ਤੋਂ ਬੜੇ ਸ਼ਹਿਰਾਂ ਦੇ ਅੰਦਰ ਜਾ ਰਹੇ ਨੇ ਉਹਨਾਂ ਨੂੰ ਆਪਣੀ ਜਗ੍ਹਾ ਬਦਲਣ ਦੀ ਵੀ ਲੋੜ ਨਹੀ ਪਏਗੀ ਉਹਦੇ ਨਾਲ ਜਿਹੜੇ ਲੋਕ ਛੋਟੇ ਸ਼ਹਿਰ ਦੇ ਅੰਦਰ ਰਹਿ ਰਹੇ ਨੇ ਉਹ ਛੋਟੇ ਸ਼ਹਿਰ ਦੇ ਅੰਦਰ ਰਹਿ ਕੇ ਹੀ ਅੱਗੇ ਵੱਧ ਸਕਦੇ ਨੇ